ਹਾਂਜੀ ਸ ਬੁਣਾਈ ਦਾ ਕੰਮ ਮੈਂ ਸ਼ੁਰੂ ਤੋਂ ਹੀ ਸਿੱਖਦੀ ਸੀ ਜੀ ਮੇਰੇ ਮੰਮਾ ਕਰਦੇ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਮੇਰੇ ਵੀ ਮਨ 'ਚ ਸ਼ੌਕ ਹੁੰਦਾ ਸੀ ਬਾਕੀ ਕੁੜੀਆਂ ਇਹੀ ਕੰਮ ਸਿੱਖਦੀਆਂ ਹੁੰਦੀਆਂ ਸੀ ਪਹਿਲਾਂ ਪੜ੍ਹਾਈ ਵੱਲ ਲੋਕਾਂ ਦਾ ਰੁਝਾਨ ਘੱਟ ਸੀਗਾ ਘੱਟ ਹੀ ਪੜ੍ਹਾਉਂਦੇ ਸੀ ਬੱਚਿਆਂ ਨੂੰ ਅਤੇ ਕੋਈ ਅੱਠ ਕੋਈ ਦਸ ਪੜ੍ਹਾ ਕੇ ਹਟਾ ਲੈਂਦਾ ਸੀਗਾ ਅਤੇ ਬੁਣਾਈ ਸਿਲਾਈ ਕਢਾਈ ਜਾਂਦੀ ਸੀਗੀ ਸਿਖਾਈ ਜਾਂਦੀ ਸੀ ਵੀ ਕੁੜੀਆਂ ਦੇ ਕੰਮ ਆਊਗੀ ਅੱਗੇ ਜਾ ਕੇ ਬੁਣਾਈ ਦਾ ਕੰਮ ਮੈਂ ਆਪਦੀ ਮੰਮੀ ਨੂੰ ਬੁਣਦੀ ਨੂੰ ਦੇਖਦੀ ਸੀ ਜੀ ਮੈਨੂੰ ਵੀ ਸ਼ੌਕ ਪੈਦਾ ਹੋ ਗਿਆ ਮੰਮਾ ਕਹਿੰਦੇ ਸੀ ਵੱਡੀ ਹੋ ਕੇ ਸਿੱਖ ਲਿਓ ਮੈਂ ਫਿਰ ਵੀ ਸਿੱਖਦੀ ਸੀ ਉਹ ਨਹੀਂ ਸਿਲਾਈਆਂ ਲੈ ਕੇ ਦਿੰਦੇ ਸੀ ਮੈਂ ਡੱਕੇ ਲੈ ਕੇ ਸਿਲਾਈਆਂ 'ਤੇ ਕੁੰਡੇ ਪਾ ਕੇ ਬੁਣਦੀ ਹੁੰਦੀ ਸੀ ਮਤਲਬ ਦਿਲ ਦੇ ਵਿੱਚ ਸ਼ੌਕ ਸੀ ਵੀ ਮੈਂ ਵੀ ਸਿੱਖਾਂ ਮੈਂ ਵੀ ਬਣਾਵਾਂ ਇਹ ਕਿੰਨੇ ਸੋਹਣੇ ਡਿਜ਼ਾਇਨ ਬਣਾਉਂਦੇ ਨੇ ਮੈਂ ਵੀ ਬਣਾਵਾਂ ਮੈਨੂੰ ਵੀ ਬਣਾਉਣੇ ਆ ਜਾਣ ਇਹੋ ਜਿਹੇ ਡਿਜਾਇਨ ਮੈਂ ਵੀ ਬਣਾਇਆ ਕਰੂੰਗੀ ਫੇਰ ਆਪਦੀ ਮਰਜ਼ੀ ਦਾ ਬਣਾ ਕੇ ਆਪਦੇ ਪਾਇਆ ਕਰੂੰਗੀ ਠੀਕ ਹੈ ਜੀ ਫੇਰ ਸਿਲਾਈ ਦਾ ਕੰਮ ਸੀ ਸਿਲਾਈ ਦਾ ਵੀ ਸ਼ੁਰੂ ਤੋਂ ਹੀ ਸਿੱਖੇ ਸੀ ਜੀ ਸਕੂਲ ਦੇ ਵਿੱਚ ਸਿਲਾਈ ਲਿੱਤੀ ਸੀਗੀ ਸਿਲਾਈ ਦੇ ਵਿੱਚ ਅਸੀਂ ਨੇ ਤੀਜੀ 'ਚ ਸਿਲਾਈ ਲੈ ਲਈ ਸੀ ਉਹਦੇ ਵਿੱਚ ਹੀ ਟਾਂਕੇ ਕਢਾਈ ਦੇ ਕੱਢਣੇ ਸਿੱਖ ਲਏ ਸੀਗੇ ਜੀ ਨਾਲੇ ਤੋਪੇ ਜਿਵੇਂ ਤਰਪਾਈ ਕਰਨੀ ਕਾਜ ਬਟਨ ਵਗੈਰਾ ਸਾਰਾ ਕੁਝ ਸਕੂਲ ਦੇ ਵਿੱਚ ਹੀ ਸਿੱਖਿਆ ਸੀ ਜੀ ਸਿਲਾਈ ਦੇ ਵਿੱਚ ਜਿਵੇਂ ਬੂਟ ਜੁਰਾਬਾਂ ਟੋਪੀ ਕੋਟੀ ਸਵੱਟਰ ਵਗੈਰਾ ਸਾਰਾ ਕੁਛ ਸਿਲਾਈ 'ਚ ਮੈਡਮਾਂ ਨੇ ਪੀਰੀਅਡ ਦੇ ਵਿੱਚ ਸਾਡਾ ਪੀਰੀਅਡ ਫਰੈਂਡ ਹੁੰਦਾ ਸੀ ਉਹਦੇ ਵਿੱਚ ਸਿਖਾਇਆ ਜਾਂਦਾ ਸੀਗਾ ਸਾਰੇ ਮਤਲਬ ਟਾਕੀਆਂ ਲਾਉਣੀਆਂ ਜਿਵੇਂ ਕੋਈ ਤੁੰਬਲ ਲੱਗ ਗਈ ਸਾਰਾ ਕੁਛ ਉਹ ਅਸੀਂ ਆਪ ਹੀ ਮਤਲਬ ਉਹਨੂੰ ਧੁੱਪਣਾ ਸੁੰਬਣਾ ਸਿੱਖਿਆ ਸਿਲਾਈ ਦੇ ਵਿੱਚ ਅਤੇ ਸਿਲਾਈ ਦੇ ਵਿੱਚ ਅਸੀਂ ਸੂਟ ਬਣਾਉਣਾ ਵੀ ਅੱਠਵੀਂ ਤੱਕ ਸਿਲਾਈ ਕੀਤੀ ਸੀ ਅੱਠਵੀਂ ਦੇ ਵਿੱਚ ਬਹੁਤ ਕੁਛ ਅੱਠਵੀਂ ਤੱਕ ਅਸੀਂ ਸਿੱਖ ਗਏ ਸੀ ਸਿਲਾਈ ਦੇ ਵਿੱਚ ਬਾਕੀ ਘਰਾਂ ਦੇ ਵਿੱਚ ਸਿੱਖ ਗਏ ਸੀ ਮਾਵਾਂ ਨੇ ਸਿਖਾਤੇ ਸੀ